ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਲੱਗਦਾ ਹੈ ਮੈਂ ਬਹੁਤ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਉਂਦੀਆਂ ਹਨ ਮੈਂ ਹਰ ਇੱਕ ਚੀਜ਼ ਦੀ ਪੇਂਟਿੰਗ ਬਣਾਈ ਹੋਈ ਹੈ ਜਿਵੇਂ ਮੈਂ ਪਾਰਕ ਵਿੱਚ ਜਾ ਕੇ ਉੱਥੇ ਬੈਠ ਕੇ ਕੁਦਰਤ ਨੂੰ ਵੇਖ ਕੇ ਬਹੁਤ ਸਾਰੀਆਂ ਪੇਂਟਿੰਗਾਂ ਬਣਾਈਆਂ ਹਨ ਮੈਂ ਪਹਾੜਾਂ ਦੀਆਂ ਵੀ ਪੇਂਟਿੰਗਾਂ ਬਣਾਈਆਂ ਹਨ ਮੈਂ ਪੇਂਟਿੰਗ ਆਪਣੇ ਗੁਰੂ ਜੀ ਕੋ ਸਿੱਖੀ ਹੈ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਸ਼ੌਕ ਸੀ ਮੈਂ ਬਚਪਨ ਤੋਂ ਹੀ ਆਪਣੀ ਕਾਪੀਆਂ ਕਿਤਾਬਾਂ ਵਿੱਚ ਪੇਂਟਿੰਗ ਬਣਾਉਦੀ ਸੀ ਜਿਸ ਕਰਕੇ ਹੁਣ ਮੈਂ ਪੇਂਟਿੰਗ ਵਿੱਚ ਬਹੁਤ ਵਧੀਆ ਹੋ ਗਈ ਹਾਂ ਪੇਂਟਿੰਗ ਕਰਨ ਨਾਲ ਮੇਰਾ ਮਨ ਕੁਦਰਤ ਵੱਲ ਆਕਰਸ਼ਕ ਹੁੰਦਾ ਹੈ ਮੈਂ ਬਹੁਤ ਨਵੇਂ ਤਰਾ ਦੀਆ ਪੇਂਟਿੰਗਾਂ ਬਣਾਈਆਂ ਹਨ ਮੈਂ ਬਹੁਤ ਜਗਹਾ ਤੇ ਜਾ ਜਾ ਕੇ ਪੇਂਟਿੰਗ ਬਣਾਈਆਂ ਹਨ ਜਿਵੇਂ ਕਿਸੀ ਦਾ ਵਿਆਹ ਹੁੰਦਾ ਹੈ ਉਹਨਾਂ ਦੋ ਨਵੇਂ ਜੋੜੇ ਦੀ ਪੇਂਟਿੰਗ ਬਣਾਈ ਹੈ ਅਤੇ ਕਿਸੀ ਜੰਗਲ ਵਿੱਚ ਜਾ ਕੇ ਉੱਥੇ ਦਾ ਨਜ਼ਾਰਾ ਵੇਖ ਕੇ ਪੇੜ ਪੌਦਿਆਂ ਨੂੰ ਵੇਖ ਕੇ ਜਾਨਵਰਾਂ ਨੂੰ ਵੇਖ ਕੇ ਪੇਂਟਿੰਗ ਬਣਾਈ ਹੈ ਮੈਨੂੰ ਪੇਂਟਿੰਗ ਕਰਨਾ ਬਹੁਤ ਵਧੀਆ ਲੱਗਦਾ ਹੈ ਪੇਂਟਿੰਗ ਮੇਰਾ ਰੁਤਬਾ ਹੈ